ਗਤਕੇ ਇੱਕ ਜਿਸ ਵਿੱਚ ਇਹ ਅੱਜ ਕੱਲ੍ਹ ਓਲੰਪਿਕ ਵਿੱਚ ਪ੍ਰਵੇਸ਼ ਕਰ ਚੁੱਕਾ ਇਸ ਦੀਆਂ ਵੱਖ ਵੱਖ ਤਕਨੀਕਾਂ ਹਨ ਸਭ ਤੋਂ ਵੱਡੀ ਤਕਨੀਕ ਹੈ ਗਤਕੇ ਖੇਡਣ ਸਮੇਂ ਬਹੁਤ ਜ਼ਿਆਦਾ ਫੁਰਤੀ ਹੋਣੀ ਚਾਹੀਦੀ ਹੈ ਅਗਰ ਅਸੀਂ ਫੁਰਤੀ ਹੋਵੇਗੀ ਅਸੀਂ ਤਾਂ ਹੀ ਆਪਣੇ ਸਾਹਮਣੇ ਵਾਲੇ ਦਾ ਟਾਕਰਾ ਕਰ ਪਾਵਾਂਗੇ ਦੂਜਾ ਸਾਡੇ ਸਰੀਰ ਵਿੱਚ ਫਲੈਕਸੀਬਿਲਿਟੀ ਫਲੈਕਸੀਬਿਲਿਟੀ ਹੋਣੀ ਚਾਹੀਦੀ ਫਲੈਕਸੀਬਿਲਿਟੀ ਹੋਵੇਗੀ ਤਾਂ ਅਸੀਂ ਉਸ ਸੋਟੀ ਨੂੰ ਉੰਨੀ ਹੀ ਤੇਜ਼ੀ ਨਾਲ ਘੁਮਾ ਸਕਾਂਗੇ ਦੂਜਾ ਸਾਡੇ ਸਰੀਰ ਵਿੱਚ ਲਚਕ ਫਲੈਕਸੀਬਿਲਟੀ ਲਚਕ ਦੀ ਗੱਲ ਹੋ ਗਈ ਆ ਉਸ ਤਰ੍ਹਾਂ ਸਾਨੂੰ ਸੁਚੇਤ ਰਹਿਣਾ ਪੈਂਦਾ ਹੈ ਸਾਹਮਣੇ ਵਾਲੇ ਬੰਦੇ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖਣਾ ਪੈਂਦਾ ਜਦੋਂ ਤੁਸੀਂ ਅੱਖਾਂ 'ਚ ਅੱਖਾਂ ਪਾ ਕੇ ਦੇਖਾਂਗੇ ਸਾਨੂੰ ਉਸ ਦਾ ਪਤਾ ਅੰਦਾਜ਼ਾ ਲੱਗਦਾ ਰਹੂਗਾ ਕਿ ਉਹ ਕਿਸ ਪਾਸਿਓਂ ਵਾਰ ਕਰਨਾ ਚਾਹੁੰਦਾ ਹੈ ਇਸ ਲਈ ਜਦੋਂ ਅੱਖਾਂ ਵਿੱਚ ਅੱਖਾਂ ਪਾਵਾਂ ਪਾ ਕੇ ਫੁਰਤੀ ਨਾਲ ਅਤੇ ਜਦੋਂ ਸਾਡੇ ਸਰੀਰ ਵਿੱਚ ਲਚਕ ਹੋਵੇਗੀ ਅਸੀਂ ਉਸ ਦੇ ਸਾਰੇ ਅਗਲੇ ਸਾਹਮਣੇ ਵਿਰੋਧੀ ਬੰਦੇ ਦੀ ਸਾਰੀ ਰਣਨੀਤੀ ਨੂੰ ਸਮਝ ਲਵਾਂਗੇ ਅਤੇ ਅਸੀਂ ਗੱਤਕੇ ਨੂੰ ਬਹੁਤ ਵਧੀਆ ਤਰੀਕੇ ਨਾਲ ਖੇਡ ਕੇ ਆਸਾਨੀ ਨਾਲ ਜਿੱਤ ਇਹਨਾਂ ਖ਼ਾਸ ਤਕਨੀਕਾਂ ਨੂੰ ਧਿਆਨ ਵਿੱਚ ਰੱਖ ਰਹੇ ਅਗਲੇ 'ਤੇ ਜਿੱਤ ਪ੍ਰਾਪਤ ਕਰ ਸਕਾਂਗੇ